ਮੇਰਾ ਮਨਪਸੰਦ ਤਾਰਾ ਮੰਡਲ ਓਰੀਅਨ ਹੈ ਜੋ ਕਿ ਸ਼ਿਕਾਰੀ ਵਜੋਂ ਜਾਣਿਆ ਜਾਂਦਾ ਹੈ ਮੈਨੂੰ ਇਹ ਇਸ ਲਈ ਪਸੰਦ ਹੈ ਕਿਉਂਕਿ ਇਸ ਦੀਆਂ ਲਾਈਨਾਂ ਅਤੇ ਚਮਕਦਾਰ ਤਾਰੇ ਬਹੁਤ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ ਜਦੋਂ ਵੀ ਮੈਂ ਓਰੀਅਨ ਨੂੰ ਵੇਖਦਾ ਹਾਂ ਤਾਂ ਇਹ ਮੈਨੂੰ ਬਚਪਨ ਦੀਆਂ ਉਹਨਾਂ ਰਾਤਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਮੈਂ ਪਰਿਵਾਰ ਦੇ ਨਾਲ ਛੱਤ 'ਤੇ ਬੈਠ ਕੇ ਤਾਰਿਆਂ ਨੂੰ ਗਿਣਦਾ ਸੀ ਓਰੀਅਨ ਦੇ ਤਾਰੇ ਬੈਟਲਜੂਸ ਅਤੇ ਰੀਗੇਲ ਖਾਸ ਕਰਕੇ ਦਿਲਚਸਪੀ ਪੈਦਾ ਕਰਦੇ ਹਨ ਕਿਉਂਕਿ ਬੈਟਲਜੂਸ ਰੰਗ ਲਾਲ ਵਜੋਂ ਜਾਣਿਆ ਜਾਂਦਾ ਹੈ ਅਤੇ ਅਸਮਾਨ ਵਿੱਚ ਇੱਕ ਵਿਲੱਖਣ ਚਮਕ ਲਿਆਉਂਦਾ ਹੈ ਰੀਗੇਲ ਦੀ ਨੀਲੀ ਚਮਕ ਇਸਨੂੰ ਹੋਰ ਵੀ ਜ਼ਿਆਦਾ ਦਿਲਕਸ਼ ਬਣਾਉਂਦੀ ਹੈ ਇਸਦੀ ਫੋਟੋ ਜੋ ਇੱਕ ਸ਼ਿਕਾਰੀ ਦੀ ਸ਼ਕਲ ਵਿੱਚ ਹੁੰਦੀ ਹੈ ਗਰੀਕ ਕਥਾਵਾਂ ਦੇ ਪੁਰਾਣੇ ਵਕਤਾਂ ਨੂੰ ਯਾਦ ਕਰਵਾਉਂਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਓਰੀਅਨ ਇੱਕ ਸ਼ਿਕਾਰੀ ਸੀ ਜਿਸ ਦੀ ਕਹਾਣੀ ਪੁਰਾਣੀ ਗਰੀਕ ਮੈਥੋਲੋਜੀ ਵਿੱਚ ਬਹੁਤ ਹੀ ਮਸ਼ਹੂਰ ਹੈ ਓਰੀਅਨ ਦੇ ਤਿੰਨ ਵਿਚਕਾਰਲੇ ਤਾਰੇ ਜੋ ਕਿ ਉਸਦੀ ਕਮ ਕਮਰ ਬਣਾਉਂਦੇ ਹਨ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ ਬਹੁਤ ਵਾਰ ਲੋਕ ਇਸ ਨੂੰ ਓਰੀਅਨ ਦੀ ਬੈਲਟ ਕਹਿੰਦੇ ਹਨ ਸਰਦੀਆਂ ਦੀਆਂ ਰਾਤਾਂ ਵਿੱਚ ਇਹ ਓਰੀਅਨ ਚਮਕਦਾਰ ਤਾਰਿਆਂ ਨਾਲ ਸਾਫ ਸੁਥਰੇ ਅਸਮਾਨ ਵਿੱਚ ਖੂਬਸੂਰਤੀ ਨਾਲ ਖਿੜਦਾ ਹੈ ਜੋ ਕਿ ਅਸਮਾਨ ਵਿੱਚ ਇੱਕ ਸ਼ੋਭਾ ਵਧਾਉਂਦਾ ਹੈ ਜਦੋਂ ਮੈਂ ਇਸ ਓਰੀਅਨ ਨੂੰ ਵੇਖਦਾ ਹਾਂ ਤਾਂ ਇਹ ਮੈਨੂੰ ਇੱਕ ਅਨੌਖੀ ਸ਼ਾਂਤੀ ਮਹਿਸੂਸ ਕਰਵਾਉਂਦਾ ਹੈ ਤਾਰਿਆਂ ਦੀ ਇਹ ਸਮੂਹ ਰਾਤ ਦੇ ਸਮੇਂ ਵਿੱਚ ਇੱਕ ਜਾਦੂਈ ਜਿਹਾ ਨਜ਼ਾਰਾ ਨਜ਼ਰ ਆਉਂਦਾ ਹੈ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਓਰੀਐਨ ਦੀ ਇਹ ਖਾਸ ਪਛਾਣ ਹੈ ਅਤੇ ਇਸ ਦੀ ਚਮਕਦਾਰ ਤਾਂ ਤਾਰਿਆਂ ਦੀ ਕਹਾਣੀ ਇਸ ਲਈ ਮੈਨੂੰ ਮਨਪਸੰਦ ਬਣਾਉਂਦੀ ਹੈ ਇਸ ਵਿੱਚ ਕੁਝ ਨਾਮ ਵੀ ਹਨ ਐਟਰੋਮੈਂਡਾ ਐਕਸ ਅਤੇ ਮਿਲਕੀ ਵੇ ਤਾਰਾ ਮੰਡਲ ਇਸ ਵਿੱਚ ਅੱਠ ਗ੍ਰਹਿ ਹਨ ਯਾਨੀ ਕਿ ਮਾਸ ਜੁਪੀਟਰ ਨੈਚੁਰਲ ਅਰਥ ਅਰਥ ਸਭ ਤੋਂ ਵਧੀਆ ਤਾਰਾ ਮੰਡਲ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਜੀਵਨ ਹਨ ਅਤੇ ਜੀਵ ਜੰਤੂ ਵੀ ਰਹਿੰਦੇ ਹਨ ਇਸ ਲਈ ਮੈਨੂੰ ਸਾਰਿਆਂ ਨਾਲੋਂ ਵਧੀਆ ਇਹ ਓਰੀਅਨ ਪਸੰਦ ਹੈ